ਪੰਜਾਬੀ ਭਾਸ਼ਾ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਸ ਨੂੰ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤਾ ਸੀ ਉਹਨਾਂ ਨੇ ਹੀ ਪੰਜਾਬੀ ਲਿਪੀ ਹੈ ਜਿਹੜੀ ਉਹ ਬਣਾਈ ਸੀ ਅਤੇ ਸ਼ੁਰੂ ਕੀਤੀ ਸੀ ਅਤੇ ਇਸ ਦੇ ਵਿੱਚ ਹੀ ਜਿਹੜੀ ਹੈ ਗੁਰਮੁਖੀ ਕਹਿ ਲਓ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਦਰਜ ਹੈ ਉਹ ਵੀ ਪੰਜਾਬੀ ਭਾਸ਼ਾ ਪੰਜਾਬੀ ਲਿਪੀ ਅਤੇ ਟਾਈਮ ਦੇ ਨਾਲ ਨਾਲ ਇਸ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਐਡ ਹੁੰਦੀਆਂ ਰਹੀਆਂ ਜਿਵੇਂ ਸਾਨੂੰ ਪੰਜ ਅੱਖਰ ਆ ਜਿਹੜੇ ਉਹ ਫਾਰਸੀ ਭਾਸ਼ਾ ਵੱਲੋਂ ਮਿਲੇ ਇੱਕ ਅੱਖਰ ਜਿਹੜਾ ਯੂਨੀਵਰਸਿਟੀ ਬੰਨਿਓ ਕਿਉਂਕਿ ਜਦੋਂ ਜਦੋਂ ਹੀ ਬਿੰਦੀ ਵਾਲੇ ਅੱਖਰਾਂ ਦੀ ਵਰਤੋਂ ਵੱਧ ਗਈ ਤਾਂ ਸਾਨੂੰ ਛੇ ਅੱਖਰ ਇਹਦੇ ਵਿੱਚ ਬਿੰਦੀ ਵਾਲੇ ਐਡ ਕਰਨੇ ਪਏ ਪਹਿਲਾਂ ਜਿਹੜੀ ਸਾਡੀ ਗੁਰਮੁਖੀ ਲਿਪੀ ਸੀ ਉਹ ਪੈਂਤੀ ਅੱਖਰੀ ਸੀ ਜਦੋਂ ਕਿ ਹੁਣ ਦੇ ਸਮੇਂ ਵਿੱਚ ਇਹ ਇੱਕਤਾਲੀ ਅੱਖਰਾਂ ਦੀ ਹੋ ਗਈ ਹੈ ਇਹਦੇ ਵਿੱਚ ਵਿਆਕਰਣ ਦੇ ਨਾਲ ਸਾਨੂੰ ਜਿਹੜੀ ਭਾਸ਼ਾ ਉਹ ਸ਼ੁੱਧ ਪੜ੍ਹਨ ਸ਼ੁੱਧ ਲਿਖਣ ਸ਼ੁੱਧ ਬੋਲਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਉਸ ਬਾਰੇ ਵੱਧ ਤੋਂ ਵੱਧ ਜਿਹੜੀ ਉਹ ਸਾਨੂੰ ਜਾਣਕਾਰੀ ਮਿਲਦੀ ਹੈ ਸਮੇਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਪੂਰੇ ਵਰਡ ਦੇ ਵਿੱਚ ਬੋਲੀ ਜਾ ਰਹੀ ਹੈ ਬਹੁਤ ਸਾਰੇ ਦੇਸ਼ਾਂ ਵਿੱਚ ਤਾਂ ਇਸ ਨੂੰ ਇੱਕ ਅਲੱਗ ਤੋਂ ਦਰਜਾ ਦਿੱਤਾ ਗਿਆ ਜਿਵੇਂ ਕਿ ਕਨੇਡਾ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਤੀਜੇ ਦਰਜੇ 'ਤੇ ਰੱਖਿਆ ਗਿਆ ਅਤੇ ਮਾਨਤਾ ਵੀ ਦਿੱਤੀ ਗਈ ਇਸ ਤਰ੍ਹਾਂ ਹੀ ਇਸ ਦਾ ਦਿਨ ਬ ਦਿਨ ਬਹੁਤ ਸਾਰਾ ਵਿਕਾਸ ਹੋ ਰਿਹਾ ਹੈ ਅਤੇ ਅੱਗੇ ਵੀ ਹੁੰਦਾ ਜਾ ਰਹੇਗਾ